ਹਾਂਜੀ ਜਿਵੇਂ ਕਿ ਮੈਂ ਪਿੱਛੇ ਜਿਹੇ ਮੇਰੇ ਘਰ ਮੇ ਦੋਸਤ ਅਚਾਨਕ ਆ ਗਏ ਸਨ ਤਾਂ ਮੈਂ ਉਸ ਵੇਲੇ ਇੱਕ ਚੀਜ਼ ਪੀਜ਼ੇ ਦਾ ਔਡਰ ਦਿੱਤਾ ਸੀ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਉਹ ਬਹੁਤ ਹੀ ਪਸੰਦ ਆਇਆ ਤਾਂ ਮੈਂ ਅ ਬਹੁਤ ਹੀ ਪਸੰਦ ਆਇਆ ਵੈਸੇ ਤਾਂ ਮੈਂ ਭਾਵੇਂ ਸ਼ਹਿਰ ਵਿੱਚ ਹੋਰ ਵੀ ਕਾਫੀ ਹੋਟਲ ਹਨ ਜਿੱਥੇ ਚੀਜ਼ ਪੀਜ਼ਾ ਬਣਦਾ ਆ ਪਰ ਮੈਂ ਤੁਹਾਡੇ ਬਾਰੇ ਕਾਫੀ ਸੁਣਿਆ ਸੀ ਕਿ ਤੁਸੀਂ ਸਾਰੀ ਚੀਜ਼ ਜੋ ਵੀ ਉਸ ਵਿੱਚ ਪਾਉਂਦੇ ਹੋ ਤਾਂ ਬਹੁਤ ਹੀ ਸਵਾਦ ਲੱਗਦਾ ਅਤੇ ਉਸ ਦੀ ਕੁਆਲਟੀ ਬਹੁਤ ਵਧੀਆ ਹੁੰਦੀ ਹੈ ਸਾਫ਼ ਸਫਾਈ ਵੀ ਬਹੁਤ ਰੱਖਦੇ ਹੋ ਤੁਸੀਂ ਉਸ ਵਿੱਚ ਅਤੇ ਬਣਾਉਣ ਵੇਲੇ ਇਹ ਸਿਹਤ ਨੂੰ ਧਿਆਨ 'ਚ ਰੱਖ ਕੇ ਤੁਸੀਂ ਬਣਾਉਂਦੇ ਹੋ ਵਾਕਈ ਉਹ ਬਹੁਤ ਸਵਾਦ ਸੀ ਮੇਰੇ ਦੋਸਤਾਂ ਨੇ ਬਹੁਤ ਹੀ ਪਸੰਦ ਕੀਤਾ ਅਤੇ ਇਸ ਲਈ ਮੈਂ ਹੁਣ ਵੀ ਤੁਹਾਡੇ ਤੋਂ ਆਰਡਰ ਰਾਹੀਂ ਚੀਜ਼ ਪੀਜ਼ਾ ਮੰਗਵਾਉਣਾ ਚਾਹੁੰਦਾ ਹਾਂ ਤੁਸੀਂ ਦਸ ਕੁ ਪੀਸ ਚੀਜ਼ ਪੀਜ਼ਾ ਦੇ ਮੇਰੇ ਪਹਿਲੇ ਵਾਲੇ ਪਤੇ 'ਤੇ ਭੇਜ ਦਿਓ ਔਰ ਭੇਜ ਦਿਓ